ਹਾਂਜੀ ਨਮਸਤੇ ਜੀ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਅੱਜ ਕੱਪੜਿਆਂ ਦੇ ਬਾਰੇ ਦੱਸਣਾ ਹੈ ਜਿੱਦਾਂ ਕਿ ਅਸੀਂ ਕੋਈ ਵੀ ਜਦੋਂ ਵੀ ਬਜ਼ਾਰ ਜਾਂਦੇ ਹਾਂ ਅਤੇ ਕੱਪੜਾ ਕੋਈ ਪਸੰਦ ਹੋਵੇ ਅਤੇ ਅਸੀਂ ਉਹਨੂੰ ਖਰੀਦਣਾ ਚਾਹੁੰਦੇ ਹਾਂ ਜਿੱਦਾਂ ਕਿ ਮੈਂ ਕੋਈ ਕੱਪੜਾ ਲੈਣਾ ਹੋਏ ਅਤੇ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਕੇ ਜਾਂਦੀ ਹਾਂ ਕਿ ਜਦੋਂ ਉਹ ਮੈਨੂੰ ਕੋਈ ਕੱਪੜਾ ਪਸੰਦ ਆਏ ਅਤੇ ਫਿਰ ਮੈਂ ਉਹਨੂੰ ਪੁੱਛਦੀ ਹਾਂ ਕਿ ਦੇਖੋ ਬੇਟਾ ਇਹ ਚੀਜ਼ ਮਤਲਬ ਕਿ ਕੱਪੜਾ ਕਿੱਦਾਂ ਦਾ ਹੈ ਤਕਰੀਬਨ ਕਿ ਦੋ ਬੰਦੇ ਜਾਣ 'ਤੇ ਕੱਪੜੇ ਨੂੰ ਚੰਗੀ ਤਰ੍ਹਾਂ ਦੇਖ ਕੇ ਹੀ ਕੱਪੜੇ ਨੂੰ ਲੈਣਾ ਪੈਂਦਾ ਹੈ ਕਿ ਅੱਜ ਕੱਲ੍ਹ ਜਿੱਦਾਂ ਗਰਮੀ ਹੈ ਅਤੇ ਜ਼ਿਆਦਾ ਤਾਂ ਲੇਡੀਜ਼ ਕੋਟਨ ਦੇ ਹੀ ਸੂਟ ਜ਼ਿਆਦਾ ਪਸੰਦ ਕਰਦੀ ਹੈ ਜਦੋਂ ਕੀ ਕੋਈ ਵੀ ਦੁਕਾਨ 'ਤੇ ਜਾਓ ਅਤੇ ਉਹਨਾਂ ਨੇ ਹਰ ਤਰ੍ਹਾਂ ਦਾ ਕੱਪੜਾ ਦਿਖਾਇਆ ਜਾਂਦਾ ਹੈ ਜ਼ਿਆਦਾਤਰ ਕਿ ਮੈਨੂੰ ਕੋਟਨ ਦੇ ਹੀ ਕੱਪੜੇ ਜ਼ਿਆਦਾ ਪਸੰਦ ਹਨ ਕਿ ਜਿੱਦਾਂ ਗਰਮੀਆਂ ਵਿੱਚ ਸੋਫਟ ਸੋਫਟ ਕੱਪੜੇ ਹੀ ਪਹਿਨਣਾ ਮੈਨੂੰ ਅੱਛਾ ਲੱਗਦਾ ਹੈ ਅਤੇ ਆਪਣੀ ਬੇਟੀ ਦੇ ਨਾਲ ਜਾਂਦੀ ਐ ਅਤੇ ਉਹਨੂੰ ਵੀ ਉਹਦੀ ਪਸੰਦ ਅਤੇ ਆਪਣੀ ਪਸੰਦ ਦੋਨਾਂ ਨੂੰ ਮਿਲਾ ਕੇ ਅਸੀਂ ਚੰਗਾ ਜਿਹਾ ਇੱਕ ਸੂਟ ਜਿੱਦਾਂ ਜ਼ਿਆਦਾਤਰ ਤੌਰ 'ਤੇ ਮੈਂ ਕੋਟਨ ਦੇ ਹੀ ਲੈ ਕੇ ਆਉਂਦੀ ਹਾਂ ਕਿਉਂਕਿ ਉਹ ਕੱਪੜਾ ਪਾਉਣ 'ਚ ਵੀ ਆਨੰਦ ਮਿਲਦਾ ਹੈ ਅਤੇ ਕੱਪੜੇ ਦੀ ਗਰੰਟੀ ਵੀ ਹੁੰਦੀ ਹੈ ਕਿ ਉਹ ਕੱਪੜਾ ਜਲਦੀ ਧੋਣ ਦੇ ਨਾਲ ਖਰਾਬ ਨਹੀਂ ਹੁੰਦਾ ਅਤੇ ਉਹ ਕਾਫੀ ਇੱਕ ਸੀਜਨ ਕੱਢ ਜਾਂਦਾ ਹੈ ਵੀ ਇਸੇ ਤਰ੍ਹਾਂ ਮੈਂ ਜਦੋਂ ਵੀ ਕੱਪੜਾ ਲੈਣਾ ਅਤੇ ਆਪਣੀ ਬੇਟੀ ਦੇ ਨਾਲ ਹੀ ਜਾਂਦੀ ਹੈ ਕਿ ਉਹਨੂੰ ਵੀ ਪਸੰਦ ਆ ਜਾਂਦਾ ਹੈ ਅਤੇ ਮੈਨੂੰ ਵੀ ਪਸੰਦ ਆ ਜਾਂਦਾ ਹੈ ਅਸੀਂ ਦੋਨਾਂ ਨੇ ਹੀ ਕੱਪੜੇ ਦੀ ਕੁਆਲਿਟੀ ਦੇਖ ਕੇ ਹੀ ਉਸ ਨੂੰ ਸਲੈਕਟ ਕਰਦੇ ਹਾਂ ਧੰਨਵਾਦ ਸ਼ੁਕਰੀਆ